ਮੈਂ ਇੱਕ ਡਾਇਟ ਆਈਟ ਮੈਂ ਇੱਕ ਡਾਈਟੀਸ਼ਨ ਦੁਆਰਾ ਆਯੋਜਿਤ ਕੁਪੋਸ਼ਣ ਦੀ ਖਾਣਾ ਪਕਾਉਣ ਦੀ ਵਰਕਸ਼ਾਪ ਵਿੱਚ ਹਿੱਸਾ ਲੈਣਾ ਚਾਹੁੰਦੀ ਹਾਂ ਅਤੇ ਮੈਨੂੰ ਰਜਿਸਟਰ ਕਰਨ ਦੀ ਜ਼ਰੂਰਤ ਸੀ ਅਤੇ ਇਸ ਲਈ ਫਿਰ ਮੈਂ ਮਤਲਬ ਦੋ ਚਾਰ ਕਲਾ ਜਗ੍ਹਾ 'ਤੇ ਜਾ ਕੇ ਉਹਨਾਂ ਦੀ ਵੈਬਸਾਈਟ 'ਤੇ ਉਪਲੱਬਧ ਓਨਲਾਈਨ ਰਜਿਸਟਰੇਸ਼ਨ ਫੋਮ ਭਰਨ ਬਾਰੇ ਵੀ ਪਤਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਕਈਆਂ ਮੈਨੂੰ ਕਿਸੇ ਨੇ ਕਲਾਊਡ ਕਿਚਨ ਦੇ ਬਾਰੇ ਵਿੱਚ ਵੀ ਦੱਸਿਆ ਹੈ ਮੈਂ ਉੱਥੇ ਵੀ ਜਾ ਕੇ ਪਤਾ ਕੀਤਾ ਹੈ ਤਾਂ ਕਿ ਮੈਂ ਆਪਣੀ ਜੋ ਡਾਇਟ ਪਲੈਨ ਬਣਾ ਰਹੀ ਹਾਂ ਉਹਨੂੰ ਅੱਗੇ ਮੈਂ ਆਪਣੇ ਵਧਾ ਸਕਾਂ ਅਤੇ ਆਪਣੇ ਕੰਮ ਨੂੰ ਅੱਗੇ ਹੋਰ ਪ੍ਰਚਲਿਤ ਕਰ ਸਕਾਂ